ਹੈਲੋ ਸਤਿ ਸ਼੍ਰੀ ਅਕਾਲ ਸਾਹਿਬ ਬਸ ਬਸ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਹਾਂਜੀ ਹਾਂਜੀ ਸਭ ਠੀਕ ਤੁਸੀਂ ਦੱਸੋ ਭਾਬੀ ਜੀ ਅਤੇ ਨਿਆਣੇ ਕਿੱਦਾਂ ਅੱਛਾ ਉਹ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਨਾ ਮੈਂ ਆਪਣੇ ਮੁੰਡੇ ਦਾ ਨਾ ਸਕੂਲ ਚੇਂਜ ਕਰਵਾਉਣਾ ਸੀ ਮੈਨੂੰ ਨਾ ਉਹਦਾ ਪਿਛਲਾ ਸਕੂਲ ਜਮ੍ਹਾਂ ਵੀ ਚੰਗਾ ਨਹੀਂ ਲੱਗ ਰਿਹਾ ਹੈ ਅਤੇ ਮੈਂ ਟੀਚਰਸ ਨੂੰ ਵੀ ਕਦੇ ਵੀ ਫ਼ੋਨ ਕਰੋ ਕੰਪਲੇਂਟਸ ਲਈ ਤਾਂ ਉਹ ਫ਼ੋਨ ਹੀ ਨਹੀਂ ਚੁੱਕਦੇ ਹਾਂਜੀ ਅਤੇ ਕਦੀ ਟੈਸਟ ਵਗੈਰਾ ਹੋਵੇ ਤਾਂ ਵੀ ਉਹ ਮਾਕਸ ਨਹੀਂ ਦੱਸਦੇ ਤਾਂ ਵੀ ਉਹ ਚੈੱਕ ਕਰਕੇ ਵਾਪਿਸ ਵੀ ਨਹੀਂ ਮੋੜਦੇ ਉਨ੍ਹਾਂ ਨੂੰ ਸਮੇਂ ਸਿਰ ਹਾਂਜੀ ਮੈਂ ਇਹ ਹੀ ਪੁੱਛਣਾ ਸੀ ਤੁਹਾਡਾ ਮੁੰਡਾ ਕਿਹੜੇ ਸਕੂਲ ਹੈ ਅੱਛਾ ਤਾਂ ਮੈਨੂੰ ਥੋੜ੍ਹਾ ਜਿਹਾ ਦਸੋਗੇ ਤੁਸੀਂ ਕਿ ਉਹ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਤਾਂ ਤੁਸੀਂ ਮੈਨੂੰ ਦੱਸੋਗੇ ਉਸ ਸਕੂਲ ਬਾਰੇ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਮੁੰਡੇ ਨੂੰ ਵੀ ਫਿਰ ਓਧਰ ਹੀ ਲਾ ਦਵਾਂ ਹਾਂਜੀ ਹਾਂਜੀ ਸੁਣਿਆ ਤਾਂ ਮੈਂ ਵੀ ਸੀ ਅੱਛਾ ਤਾਂ ਤੁਸੀਂ ਕੀ ਸੋਚਦੇ ਓ ਕਿ ਕਿਹੜਾ ਸਕੂਲ ਸਾਨੂੰ ਪ੍ਰੈਫਰ ਕਰਨਾ ਚਾਹੀਦਾ ਹੈ ਹਾਂਜੀ ਡੀ ਪੀ ਐੱਸ ਮੈਂ ਸੁਣਿਆ ਤਾਂ ਸੀ ਪਰ ਮੈਂ ਸੁਣਿਆ ਸੀ ਉਹਦੀ ਫ਼ੀਸ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਨਹੀਂ ਬੱਚੇ ਦਾ ਨਾ ਇਹ ਹੀ ਟਾਈਮ ਹੈ ਖੇਲ੍ਹਣ ਦਾ ਮੈਂ ਸੋਚ ਰਹੀ ਸੀ ਮੁੰਡੇ ਨੂੰ ਵੀ ਸੀ ਐਮ ਜਾਂ ਡੀ ਐ ਵੀ ਵੱਲ ਲਾ ਦੇਵਾਂ ਬਹੁਤ ਨਾਮ ਸੁਣਿਆ ਸੀ ਉਨ੍ਹਾਂ ਦਾ ਵੀ

ਹਾਂਜੀ ਹਾਂਜੀ ਮੈਂ ਵੀ ਸੁਣਿਆ ਸੀ ਅਤੇ ਮੈਂ ਸੁਣਿਆ ਸੀ ਪ੍ਰਿੰਸੀਪਲ ਵੀ ਠੀਕ ਠਾਕ ਹੀ ਹੈ ਮੈਂ ਸੁਣਿਆ ਸੀ ਪ੍ਰਿੰਸੀਪਲ ਵੀ ਠੀਕ ਨੇ ਉਸ ਸਕੂਲ ਦੇ ਹਾਂਜੀ ਬੋਰਡ ਕਲਾਸਾਂ ਵਿੱਚ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਹਾਂਜੀ ਟਾਈਮ ਇਹ ਹੀ ਹੈ ਜੇ ਇਸ ਕ ਵੇਲੇ ਸਟੇਟ ਜਾਂ ਨੈਸ਼ਨਲ ਵੱਲ ਚੱਲੇ ਜਾਣ ਤਾਂ ਫਿਰ ਉਨ੍ਹਾਂ ਨੂੰ ਅੱਗੇ ਕੋਲਜ ਵਿੱਚ ਅਡਮੀਸ਼ਨ ਲਈ ਵੀ ਹੈਲਪ ਹੋ ਜਾਏਗੀ ਹਾਂ ਹਾਂ ਹਾਂ ਅਤੇ ਕੋਲਜ ਵਿੱਚ ਥੋੜ੍ਹੀ ਬਹੁਤ ਕਈਆਂ ਵਿੱਚ ਕੋਟਾ ਵੀ ਹੁੰਦਾ ਹੈ ਨਾ ਸਟੇਟ ਜਾਂ ਨੈਸ਼ਨਲ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਨਾ ਇੱਕ ਵਾਰੀ ਪਤਾ ਕਰਕੇ ਦੱਸਿਓ ਮੈਂ ਕਹਿ ਰਹੀ ਆ ਤੁਸੀਂ ਇੱਕ ਵਾਰ ਮੈਨੂੰ ਪਤਾ ਕਰਕੇ ਦੱਸਿਓ ਉਸ ਸਕੂਲ ਦਾ ਕੀ ਹਿਸਾਬ ਕਿਤਾਬ ਹੈ ਹਾਂਜੀ ਹਾਂਜੀ ਹਾਂਜੀ ਉਹ ਤਾਂ ਕੋਈ ਟੈਨਸ਼ਨ ਨਹੀਂ ਉਹ ਤਾਂ ਥੋੜ੍ਹਾ ਚਿਰ ਪੜ੍ਹ ਲੈਣ ਦੋਨੋਂ ਇਕੱਠੇ ਬੈਠ ਕੇ ਹਾਂਜੀ ਹਾਂਜੀ ਹਾਂਜੀ ਚਲੋ ਫ਼ਿਰ ਪਤਾ ਕਰਨਾ ਇਸ ਵਾਰੀ ਇਸ ਅਕੈਡਮਿਕ ਸੀਜ਼ਨ ਦੇ ਵਿੱਚ ਕੀ ਕੀ ਬਣਦਾ ਉਨ੍ਹਾਂ ਦੋਨਾਂ ਦਾ ਹਾਂਜੀ ਹਾਂਜੀ ਬਾਕੀ ਸਭ ਬਸ ਬਸ ਰੱਬ ਦੀ ਮਿਹਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਜੀ ਧੰਨਵਾਦ ਜੀ